ਹਾਂਜੀ ਵੀਰੇ ਹਾਂਜੀ ਹਾਂਜੀ ਵੀਰੇ ਬੋਲੋ ਅੱਛਾ ਵੀਰੇ ਬੋਲੋ ਅੱਛਾ ਹਾਂਜੀ ਵੀਰ ਅੱਛਾ ਜੀ ਠੀਕ ਐ ਅੱਛਾ ਅੱਛਾ ਵੀਰੇ ਹਾਂਜੀ ਹਾਂਜੀ ਵੀਰੇ ਉਹ ਮੈਂ ਵੀ ਇਨਸ਼ਾ ਲੋ ਕਰਮੀ ਜੀ ਚਲਦੀ ਇਨਾ ਵੀ ਮੌਸਮ ਦੇ ਹਿਸਾਬ ਨਾਲ ਹੀ ਇਥੇ ਗਰਮੀ ਸਰਦੀ ਹੁੰਦੀ ਐ ਹਿਮਾਚਲ ਦਾ ਤਾਂ ਵੀ ਇਹ ਹੋ ਗਿਆ ਨਾ ਉਥੇ ਬਰਸਾਤਾਂ ਹੁੰਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਹਾਂਜੀ ਨਹੀਂ ਹਾਲੇ ਤਾਂ ਮਤਲਬ ਕਿ ਗਰਮੀ ਤੁਸੀਂ ਹਲੇ ਤਾਂ ਵੀ ਮਹੀਨਾ ਰੁਕ ਕੇ ਮੰਗਾਓ ਜੇ ਕੱਪੜੇ ਗਰਮ ਮੰਗਾਣੇ ਨੇ ਤਾਂ ਹਾਲੇ ਤਾਂ ਇੱਥੇ ਮੌਸਮ ਮਤਲਬ ਵੀ ਠੀਕ ਚੱਲ ਰਿਹਾ ਹਾਲੇ ਤਾਂ ਵੀ ਆਪਣੇ ਤੇਜ ਹੀ ਪੱਖੀ ਚੱਲ ਰਹੇ ਨੇ ਬਾਕੀ ਬਾਕੀ ਜੇ ਤੁਸੀਂ ਇਹਦਾ ਇਥੇ ਸਾਡੇ ਜੋਤੀਬੇਸ਼ਨ ਲਈ ਤਾਂ ਬਹੁਤ ਬਹੁਤ ਧੰਨਵਾਦ ਸਹੀ ਐ ਸਾਡਾ ਕਾਲਜ ਬਹੁਤ ਵਧੀਆ ਹਾਂਜੀ ਇਥੇ ਬੜੇ ਬੱਚੇ ਇਥੇ ਮਤਲਬ ਕੀ ਟੀਚਰ ਕਾਫੀ ਵਧੀਆ ਨੇ ਬੜਾ ਅੱਛਾ ਗਾਈਡ ਕਰਦੇ ਨੇ ਟੀਚਰ ਨੂੰ ਬੱਚੇ ਨੂੰ ਹਾਂਜੀ ਮੈਨੂੰ ਵੀ ਇੱਥੇ ਤਿੰਨ ਸਾਲ ਹੋ ਗਏ ਹਾਂਜੀ ਰੈਗਿੰਗ ਵਗੈਰਾ ਮਤਲਬ ਨੀ ਇਥੇ ਨਾ ਬੈਡ ਮੀੀ ਤੇ ਬਾਕੀ ਇਥੇ ਵੀ ਮਾਹੌਲ ਅੱਛਾ ਸਾਡੇ ਕਾਲਜ ਕੋਈ ਡਰ ਵਾਲੀ ਕੋਈ ਦਿੱਕਤ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਤੁਸੀਂ ਵੀ ਇਥੇ ਵੀ ਜੇ ਤੁਹਾਡੇ ਕੋਲ ਕੋਈ ਇਥੇ ਵੀ ਜੇ ਤੁਹਾਡੇ ਕੋਲ ਕੋਈ ਇਥੇ ਰਹਿ ਸਕਦੇ ਤੇ ਵੀ ਆਪਣੇ ਇਥੇ ਵੀ ਰਹਿਣ ਨੂੰ ਵੀ ਕਾਫੀ ਜਗ੍ਹਾ ਹੈਗੀ ਨਾ ਬਸ ਵੀ ਆਪਣੇ ਕੰਟੀਨ ਹੈਗੀ ਵੈਸੇ ਤੁਸੀਂ ਇਥੇ ਵੀ ਰਹਿ ਸਕਦੇ ਹੋ ਬਾਕੀ ਤੇ ਕੋਲ ਤਾਂ ਪੜਾਈ ਤਾਂ ਬਹੁਤ ਵਧੀਆ ਇਥੇ ਹਾਂਜੀ ਹਾਂ ਬਹੁਤ ਵਧੀਆ ਟੀਚਰ ਅੱਛਾ ਗਾਈਡ ਕਰਦੇ ਬੜਾ ਵਧੀਆ ਬਣਾਉਂਦੇ ਨੇ ਕਈ ਵਾਰੀ ਬੱਚੇ ਨੇ ਜਿਵੇਂ ਸਮਝ ਨਾ ਵੀ ਲੱਗੇ ਤਾਂ ਵੀ ਦੁਬਾਰਾ ਵੀ ਪੁੱਛਦਾ ਟੀਚਰ ਨੂੰ ਤੇ ਸਮਝਾਉਂਦੇ ਵੀ ਨੇ ਹਾਂਜੀ ਤੇ ਬਾਕੀ ਮੌਸਮ ਦੇ ਬਾਰੇ ਤੁਸੀਂ ਪੁੱਛਣਾ ਚਾਹ ਰਹੇ ਹੋ ਤੋ ਮੌਸਮ ਦੇ ਹਿਸਾਬ ਨਾਲ ਤਾਂ ਤੇ ਇੱਥੇ ਹਾਲੇ ਕੋਈ ਇਨੀ ਜਿਆਦਾ ਗਰਮੀ ਠੀਕ ਠੰਡਾ ਲਿਆ ਹੈ ਨਹੀਂ ਜਿੱਥੇ ਹਾਂਜੀ ਹਾਂਜੀ ਤੇ ਤੁਸੀਂ ਨਹੀਂ ਤੇ ਆਪਣੇ ਇਹ ਗਰਮ ਕੱਪੜੇ ਤਾਂ ਹਾਲੇ ਮਿਲਕ ਵੀ ਨਾ ਲੈ ਕੇ ਆਏ ਜੇ ਤੇ ਨਾ ਮੰਗਾ ਜੇ ਤੁਸੀਂ ਇਥੇ ਆ ਚੁੱਕੇ ਹੋ ਤੇ ਫਿਰ ਤੁਹਾਡੇ ਗਰਮ ਕੱਪੜੇ ਰੋਕੇ ਮੰਗਾਓ ਹਲੇ ਤਾਂ ਲੋੜ ਹੀ ਨਹੀਂ ਗਰਮ ਕੱਪੜੇ ਮੰਗਾਉਣ ਦੀ ਤੇ ਹਾਲੇ ਤਾਂ ਲੱਗੀ ਉਥੇ ਤੁਹਾਡੇ ਹਿਸਾਬ ਨਾਲ ਉਥੇ ਮਤਲਬ ਮੌਸਮ ਚੇਂਜ ਹੋਇਆ ਹ ਨਾ ਇਹ ਆਪਣੇ ਠੰਡ ਉਥੇ ਪੈਰੀ ਹੋਣੀ ਕਿਉਂਕਿ ਬਰਸਾਤ ਉਥੇ ਜਦੋਂ ਮਰਜੀ ਪੈ ਜਾਂਦੀ ਐ ਨਾ ਸਾਡੇ ਤੇ ਬਰਸਾਤਾਂ ਮੌਸਮ ਦੇ ਹਿਸਾਬ ਨਾਲ ਹੀ ਹੁੰਦੀਆਂ ਨੇ ਤੇ ਬਾਕੀ ਤੁਸੀਂ ਰੋਕ ਕੇ ਮੰਗਾ ਸਕਦੇ ਕੋਈ ਗੱਲ ਨਹੀਂ ਤੇ ਤੁਸੀਂ ਆਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਮੌਸਮ ਬਹੁਤ ਵਧੀਆ ਸਾਡੇ ਇਥੇ ਹਾਂਜੀ ਬੇਨਤੀ ਕਰੋ ਕਿ ਅੱਜ ਠੀਕ ਹੈ ਜੀ